ਹੈਲੋ ਵਧੀਆ ਵਧੀਆ ਭਰਾ ਤੂੰ ਸੁਣਾ ਹੋਰ ਕੀ ਹਾਲ ਨੇ ਹਾਂ ਹਾਂ ਹਾਂ ਤੂੰ ਸੁਣਾ ਘਰ ਪਰਿਵਾਰ ਠੀਕ ਠਾਕ ਅੱਜ ਕਿਵੇਂ ਫੋਨ ਲਾਉਣਾ ਹੋ ਗਿਆ ਬਸ ਵਧੀਆ ਵਧੀਆ ਤੂੰ ਸੁਣਾ ਉਰੇ ਸਕੂਲ ਤਾਂ ਬਹੁਤ ਸਾਰੇ ਹੈਗੇ ਨੇ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਲੈਵਲ ਦੱਸੋ ਨਾ ਵੀ ਬੱਚੇ ਕਿਹੜੀ ਕੁਆਲੀਫਿਕੇਸ਼ਨ ਕਰ ਰਹੇ ਨੇ ਅੱਛਾ ਅੱਛਾ ਪਲੇ ਵੇ 'ਚ ਪਾਉਣਾ ਉਰੇ ਤੁਸੀਂ ਮਤਲਬ ਲੋਕਲ ਹੀ ਲੋਕਲ ਹੀ ਰੱਖਣਾ ਬੱਚੇ ਨੂੰ ਵੀਰੇ ਫੈਸਿਲਿਟੀ ਵਾਸਤੇ ਤਾਂ ਬਹੁਤ ਸਕੂਲ ਨੇ ਗਵਰਮੈਂਟ 'ਚ ਪਾਓਗੇ ਜਾਂ ਤੁਸੀਂ ਸਰ ਏ ਪ੍ਰਾਈਵੇਟ 'ਚ ਰੱਖੋਗੇ ਬੱਚੇ ਨੂੰ ਹਾਇਰ ਐਜੂਕੇਸ਼ਨ ਵਾਲੇ ਵੀਰੇ ਫਿਰੋਜ਼ਪੁਰ ਵਿੱਚ ਕ ਸਕੂਲ ਤਾਂ ਬਹੁਤ ਜ਼ਿਆਦਾ ਨੇ ਜਿਵੇਂ ਹੋ ਗਿਆ ਦਿੱਲੀ ਪਬਲਿਕ ਸਕੂਲ ਹੋ ਗਿਆ ਦਾਸ ਐਂਡ ਬਰਾਊਨ ਹੋ ਗਿਆ ਡੀ ਸੀ ਮਾਡਲ ਹੋ ਗਿਆ ਪਬਲਿਕ ਹੋ ਗਿਆ ਅਤੇ ਹੋਰ ਬੜੇ ਸਕੂਲ ਨੇ ਤੁਸੀਂ ਇਹਨਾਂ ਵਿੱਚ ਹਾਈ ਟ੍ਰੇਨਿੰਗ ਵਾਲੇ ਟੀਚਰਸ ਵੀ ਹੈਗੇ ਨੇ ਵਧੀਆ ਫੈਸਿਲੀਟੀ ਕੰਪਿਊਟਰ ਵਾਸਤੇ ਨੋਲਜ ਵੀ ਦਿੰਦੇ ਬੱਚਿਆਂ ਨੂੰ ਅਤੇ ਇਸ ਸਕੂਲ ਦੀਆਂ ਬੱਸਾਂ ਵੀ ਬਹੁਤ ਵਧੀਆ ਚੱਲਦੀਆਂ ਨੇ ਘਰ ਤੋਂ ਲੈ ਡਰੋਪ ਪਿਕ ਐਂਡ ਡਰੋਪ ਕਰਦੀਆਂ ਬੱਚੇ ਨੂੰ ਹਾਂ ਫੁੱਲ ਸੇਫਟੀ ਬੱਚੇ ਦੀ ਬਾਕੀ ਤੁਸੀਂ ਸਾਡੇ ਪਲੇ ਵੇ ਸਕੂਲ ਵਾਸਤੇ ਬੱਚੇ ਨੂੰ ਤੁਸੀਂ ਹੋਰ ਜੂਨ ਜੂਨੀਅਰ ਹੈਗਾ ਫੋਰ ਡਿਜ਼ਨੀ ਲੈਂਡ ਵਾਲਿਆਂ ਦਾ ਸਕੂਲ ਹੈਗੇ ਬੱਚਿਆਂ ਦੇ ਤੁਸੀਂ ਉੱਥੇ ਵੇਖ ਸਕਦੇ ਜੀ ਆਪਦੇ ਬੱਚੇ ਨੂੰ ਪਾ ਸਕਦੇ ਹੋ ਹਾਂਜੀ ਹਾਂਜੀ ਪ ਵੀਰੇ ਫੀਸ ਤਾਂ ਬੱਚੇ ਦੀ ਉਹ ਪ੍ਰਿੰਸੀਪਲ ਦੇ ਅਕੋਰਡਿੰਗ ਦੱਸਣਗੇ ਬੱਚੇ ਦੀ ਐਜੂਕੇਸ਼ਨ ਲੈਵਲ ਦੇ ਅਕੋਰਡਿੰਗ ਦੱਸਣਗੇ ਤਾਂ ਜਨਰਲ ਐਸ ਸੀ ਦੇ ਹੁੰਦੀ ਹੈ ਅਕੋਰਡਿੰਗ ਤੁਹਾਡੀ ਕਾਸਟ ਦੇ ਅਕੋਰਡਿੰਗ ਹੋਵੇਗੀ ਹਾਂਜੀ ਹਾਂਜੀ ਬਾਕੀ ਉਹ ਵੀਰੇ ਉਹ ਵੀਰੇ ਸਾਰਾ ਉਹ ਸਾਰਾ ਵੀਰੇ ਫੀਸ ਦੇ ਵਿੱਚ ਹੀ ਮਰਜ ਕਰ ਦਿੰਦੇ ਆ ਬਾਕੀ ਕੋਈ ਐਕਸਟਰਾ ਚਾਰਜਸ ਨਹੀਂ ਹੈਗੇ ਬੱਚੇ ਸਕੂਲ ਦੇ ਵਿੱਚ ਬਾਕੀ ਤੁਸੀਂ ਦੇਖਣਾ ਚਾਹੁੰਦੇ ਹੋ ਫਿਰੋਜ਼ਪੁਰ ਵਿੱਚ ਗੋਰਮੈਂਟ ਸਕੂਲ ਵੀ ਬਹੁਤ ਵਧੀਆ ਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਨਾਂ ਦੇ ਵਿੱਚ ਤਾਂ ਸਭ ਐਮ ਏ ਬੀ ਏ ਸਾਰੇ ਪੀ ਐਚ ਡੀ ਡਿਗਰੀਆਂ ਵਾਲੇ ਹੁੰਦੇ ਨੇ ਹਾਂਜੀ ਹਾਂਜੀ ਹਾਂਜੀ ਉਹ ਸਰਕਾਰੀ ਹਾਂਜੀ ਹਾਂਜੀ ਉਹ ਤਾਂ ਪਲੇ ਵੇ ਬੱਚਿਆਂ ਵਾਸਤੇ ਤਾਂ ਨਹੀਂ ਹੋਵੇਗਾ ਬਟ ਜੋ ਨੋਰਮਲ ਫਿਫਥ ਕਲਾਸ ਦੇ ਸਟੈਂਡਰਡ ਵਾਸਤੇ ਤੁਸੀਂ ਬੱਚੇ ਨੂੰ ਕਹਿ ਰਹੇ ਹੋ ਨਾ ਤਾਂ ਫਿਫਥ ਦੇ ਬੱਚੇ ਵਾਸਤੇ ਇਹ ਐਜੂਕੇਸ਼ਨ ਲੈਵਲ ਸਹੀ ਹੋਵੇਗਾ ਹੁਣ ਥੋੜ੍ਹਾ ਖੇਡਾਂ ਵੱਲ ਵੀ ਬੱਚੇ ਦਾ ਧਿਆਨ ਰੱਖਿਆ ਜ਼ਰੂਰੀ ਰੱਖਣਾ ਜ਼ਰੂਰੀ ਹੁੰਦਾ ਹੈ ਇਸ ਕਰਕੇ ਉਹ ਫਿਜੀਕਲ ਲੈਕਚਰ ਵੀ ਜ਼ਰੂਰ ਲੱਗਦੇ ਆ ਉੱਥੇ ਖੇਡਾਂ ਵਾਸਤੇ ਵੀ ਖਾਸ ਪ੍ਰਬੰਧ ਹੈਗਾ ਤੁਸੀਂ ਤੁਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਵੀਰੇ ਤੁਸੀਂ ਨਾ ਜੋ ਜਿਹੜੇ ਵੀ ਸਕੂਲ ਵਿੱਚ ਪਾਉਣਾ ਚਾਹੁੰਦੇ ਹੋ ਨਾ ਬੱਚੇ ਨੂੰ ਤੁਸੀਂ ਮੇਰਾ ਕੰਟੈਕਟ ਨੰਬਰ ਲੈ ਸਕਦੇ ਹੋ ਤਾਂ ਉੱਥੇ ਜਾ ਕੇ ਕਿਸੇ ਵੀ ਸਟੂਡੈਂਟ ਜਾਂ ਪ੍ਰਿੰਸੀਪਲ ਟੀਚਰ ਨਾਲ ਮੇਰੀ ਗੱਲ ਕਰਵਾ ਦਿਆ ਜਿਓ ਉੱਥੇ ਤੁਹਾਨੂੰ ਚੰਗੀ ਤਰ੍ਹਾਂ ਤੁਹਾਨੂੰ ਫੈਸਿਲਿਟੀ ਦੇ ਦੇਣਗੇ ਬੱਚੇ ਦੀ ਹਾਇਰ ਐਜੂਕੇਸ਼ਨ ਵਾਸਤੇ ਹਾਂਜੀ ਹਾਂਜੀ ਵੀਰੇ ਹਾਂਜੀ ਹਾਂਜੀ ਵੀਰੇ ਵਧੀਆ ਵਧੀਆ ਵਧੀਆ ਤੁਸੀਂ ਸੁਣਾਓ ਅਸੀਂ ਤਾਂ ਵੀਰੇ ਡੀ ਸੀ ਮਾਡਲ ਪਾਏ ਹੋਏ ਇੰਟਰਨੈਸ਼ਨਲ ਸਕੂਲ ਦੇ ਵਿੱਚ ਹਾਂਜੀ ਹਾਂਜੀ ਹਾਂਜੀ ਬਹੁਤ ਬਹੁਤ ਵਧੀਆ ਚੱਲਦੀ ਬੱਚੇ ਨ ਫੁੱਲ ਨੋਲੇਜ ਲੈ ਕੇ ਆਉਂਦੇ ਨੇ ਉਹ ਬਹੁਤ ਵਧੀਆ ਹਾਂਜੀ ਹਾਂਜੀ ਇਹ ਵੀਰੇ ਤੁਸੀਂ ਜੇ ਡੀ ਸੀ ਮਾ ਤੁਸੀਂ ਡੀ ਸੀ ਮਾਡਲ ਪਾਉਣਾ ਚਾਹੁੰਦੇ ਜੇ ਤੁਸੀਂ ਤਾਂ ਇੱਥੇ ਇੱਕ ਹੈਗਾ ਇੱਕ ਤਾਂ ਹੈਗਾ ਆਪਣਾ ਫਿਰੋਜ਼ਪੁਰ ਦੇ ਵਿੱਚ ਕੈਂਟ ਡੀ ਸੀ ਮਾਡਲ ਇੰਟਰਨੈਸ਼ਨਲ ਸਕੂਲ ਅਤੇ ਇੱਕ ਹੈਗਾ ਆਪਣਾ ਵੀਰੇ ਸਿਟੀ ਦੇ ਵਿੱਚ ਈਸੇਵਾਲਾ ਰੋਡ ਈਸੇਵਾਲਾ ਪਿੰਡ ਦੇ ਕੋਲ ਹੀ ਹੈ ਵੀਰੇ ਸਕੂਲ ਹਾਂਜੀ ਰੱਖੜੀ ਰੋਡ 'ਤੇ ਹਾਂਜੀ ਹਾਂਜੀ ਧੰਨਵਾਦ ਵੀਰੇ